ਭਾਰਤ ਇੱਕ ਲੋਕਤੰਤਰ ਦੇਸ਼ ਹੈ ਇਸ ਦੀ ਨਿਆਪਾਲਿਕਾ ਨਿਰਪੱਖ ਅਤੇ ਸੁਤੰਤਰ ਹੈ ਕਿਸੇ ਵੀ ਰਾਜ ਦੀ ਤਰੱਕੀ ਉਸਦੀ ਨਿਆਪਾਲਿਕਾ ਤੇ ਬਹੁਤ ਨਿਰਭਰ ਕਰਦੀ ਹੈ ਸਭ ਤੋਂ ਥੱਲੇ ਸਥਾਨਕ ਕਚਹਿਰੀਆਂ ਉਸ ਤੋਂ ਉੱਪਰ ਹਾਈਕੋਰਟ ਅਤੇ ਸਭ ਤੋਂ ਉੱਪਰ ਸਰਵਉੱਚ ਅਦਾਲਤ ਹੁੰਦੀ ਹੈ ਕਚਹਿਰੀ ਵਿਚਾਲੇ ਮੁੱਦਿਆਂ ਨੂੰ ਨਿਆਪਾਲਿਕਾ ਕ੍ਰਿਮੀਨਲ ਕੇਸਿਸ ਘਰੇਲੂ ਮੁੱਦੇ ਆਦਿ ਕਈ ਤਰੀਕਿਆਂ ਨਾਲ ਵੰਡਦੀ ਹੈ ਇਹਨਾਂ ਮੁੱਦਿਆਂ ਦੇ ਹਿਸਾਬ ਨਾਲ ਇਹ ਵੱਖ ਵੱਖ ਜਜਾਂ ਅਤੇ ਕਚਹਿਰੀਆਂ ਵਿੱਚ ਫੈਸਲੇ ਜਾਂਦੇ ਹਨ ਨਿਆ ਪਾਲਿਕਾ ਨੂੰ ਹੱਕ ਹੈ ਕਿ ਕਿਸੇ ਵੀ ਕਾਰਜਕਾਰੀ ਮੰਤਰੀ ਅਤੇ ਵਿਧਾਨਕ ਸੰਸਥਾਵਾਂ ਨੂੰ ਚੁਨੌਤੀ ਦੇ ਸਕਦੀ ਹੈ ਜਦੋਂ ਵੀ ਸਰਕਾਰੀ ਕੰਮਾਂ ਵਿੱਚ ਕੋਈ ਢਿੱਲ ਜਾਂ ਭਰਿਸ਼ਟਾਚਾਰ ਦੇਖਦੀ ਹੈ ਉਹ ਕਿਸੇ ਵੀ ਦਸਤਾਵੇਜ਼ ਨੂੰ ਮੰਤਰੀ ਜਾ ਕਚਹਿਰੀ ਵਿੱਚ ਪੇਸ਼ ਕਰਨ ਦੀ ਜਾਂ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਰੱਖਦੀ ਹੈ